ਪੰਜਾਬ ਵਿੱਚ ਕਈ ਸੱਭਿਆਚਾਰਕ ਪ੍ਰੰਪਰਾਵਾਂ ਹਨ ਜਿਨ੍ਹਾਂ ਦਾ ਇਤਿਹਾਸ ਬਹੁਤ ਲੰਬਾ ਹੈ ਅਤੇ ਅੱਜ ਵੀ ਲੋਕਾਂ ਦੁਆਰਾ ਉਹਨਾਂ ਦਾ ਅਭਿਆਸ ਕੀਤਾ ਜਾਂਦਾ ਹੈ ਜਿਵੇਂ ਰਾਮਲੀਲਾ ਵਿਸਾਖੀ ਦਾ ਮੇਲਾ ਲੋਹੜੀ ਦਾ ਤਿਉਹਾਰ ਦਿਵਾਲੀ ਆਦਿ ਇਹਨਾਂ ਪਰੰਪਰਾਵਾਂ ਨੂੰ ਸਮਾਜ ਦੀ ਬਣਾਵਟ ਦਾ ਹਿੱਸਾ ਮੰਨਿਆ ਜਾਂਦਾ ਹੈ ਇਹ ਪੰਜਾਬੀ ਸੱਭਿਆਚਾਰ ਨੂੰ ਸੁੰਦਰ ਬਣਾਉਂਦਾ ਹੈ ਅਤੇ ਲੋਕਾਂ ਦੇ ਜੀਵਨ ਵਿੱਚ ਅਨੰਤ ਅਤੇ ਖੁਸ਼ੀ ਲਿਆ ਦਿੰਦਾ ਹੈ ਇਹਨਾਂ ਵਿੱਚੋਂ ਰਾਮਲੀਲਾ ਇੱਕ ਸੱਭਿਆਚਾਰਕ ਪ੍ਰੰਪਰਾ ਹੈ ਜੋ ਪੰਜਾਬ ਵਿੱਚ ਅੱਜ ਵੀ ਬਹੁਤ ਵਿਖਿਆਤ ਹੈ ਇਹ ਰਮਾਇਣ ਕਥਾ ਨੂੰ ਦਰਸਾਉਂਦੀ ਹੈ ਅਤੇ ਲੋਕਾਂ ਵਿੱਚ ਏਕਤਾ ਅਤੇ ਭਗਤੀ ਦਾ ਸਾਂਝਾ ਆਤਮਿਕ ਅਨੁਭਵ ਪੇਸ਼ ਕਰਦੀ ਹੈ ਰਾਮਲੀਲਾ ਸੱਭਿਆਚਾਰਕ ਸੰਸਕ੍ਰਿਤੀ ਨੂੰ ਮਜਬੂਤ ਕਰਦੀ ਹੈ ਅਤੇ ਲੋਕ ਸੰਗੀਤ ਨ੍ਰਿੱਤਕੀ ਅਤੇ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਇਸ ਪ੍ਰੰਪਰਾ ਵਿੱਚ ਮੁੱਖ ਭੂਮਿਕਾ ਜਿਹੜੇ ਆ ਅਭਿਨੇਤਾ ਅਤੇ ਅਭਿਨੇਤਰੀਆਂ ਦੁਆਰਾ ਨਿਭਾਈ ਜਾਂਦੀ ਹੈ ਇਹ ਤਿਉਹਾਰ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਸਾਡੀ ਸਮਾਜਿਕ ਸੰਸਕ੍ਰਿਤੀ ਨੂੰ ਉਤਸ਼ਾਹ ਵਧਾਉਂਦਾ ਹੈ ਧੰਨਵਾਦ